ਮੇਰੇ ਜਿਹੜੇ ਖੇਤਰ ਦੇ ਸਿਲਾਈ ਬੁਣਾਈ ਦਾ ਪੈਟਰਨ ਹੈ ਜਾਂ ਕੁਝ ਵਿਲੱਖਣ ਤਕਨੀਕਾਂ ਬਾਰੇ ਹੈ ਉਹ ਇਹ ਹੈ ਵੀ ਮੈਂ ਪੰਜਾਬ ਤੋਂ ਬਿਲੋਂਗ ਕਰਦਾਂ ਅਤੇ ਸਾਡੇ ਪੰਜਾਬੀ ਸੂਟ ਫੁਲਕਾਰੀਆਂ ਆਦਿ ਹੁੰਦੀਆਂ ਨੇ ਅਤੇ ਜਿਹੜੇ ਰਵਾਇਤੀ ਕੱਪੜੇ ਨੇ ਸਾਡੇ ਇਹਨਾਂ ਬਾਰੇ ਹੀ ਮੈਂ ਜਾਣਦਾ ਅਤੇ ਬਾਕੀ ਇਹ ਲੇਡੀਜ਼ ਦਾ ਕੰਮ ਹੈ ਇਹ ਜ਼ਿਆਦਾਤਰ ਮੇਰੇ ਘਰਦੇ ਹੀ ਕਰਦੇ ਹਨ